ਲੋਕ ਵਿਆਹ ਵਿੱਚ ਲਾੜੀ ਨੂੰ ਕਾਫੀ ਕੁਝ ਦਿੰਦੇ ਹਨ ਜਿਵੇਂ ਕਿ ਫਰਨੀਚਰ ਦਾਲ ਫਰਨੀਚਰ ਅਤੇ ਦਾਜ ਦਾ ਸਮਾਨ ਦਿੰਦੇ ਹਨ ਕਿਵੇਂ ਕਿ ਗਿਫਟ ਬਹੁਤ ਸਾਰੇ ਹੁੰਦੇ ਹਨ ਗਿਫਟ ਅਤੇ ਸ ਕਈ ਪਾਸੇ ਸੋਨ ਝੂਮ ਸੋਨੇ ਦੇ ਸੋਨੇ ਦੇ ਕੰਗਣ ਚੂੜੀਆਂ ਚਾੜੀਆਂ ਬਹੁਤ ਪਾਉਂਦੇ ਹਨ ਬਹੁਤ ਸਾਰੇ ਲੋਕ ਬਹੁਤ ਤਰ੍ਹਾਂ ਦੇ ਜਾਣੀ ਕਿ ਤੋਹਫੇ ਲੈ ਕੇ ਆਉਂਦੇ ਹਨ ਹਰ ਤਰ੍ਹਾਂ ਦੇ ਲੋਕਾਂ ਦੇ ਅਲੱਗ ਅਲੱਗ ਤੋਹਫੇ ਹਨ ਹਰੇਕ ਤਰ੍ਹਾਂ ਲੋਕ ਪਿਆਰ ਮੁਹੱਬਤ ਨਾਲ ਜਾਣੀ ਕਿ ਲੜਕੀ ਨੂੰ ਵਿਦਾ ਕਰਦੇ ਹਨ ਜਾਣੀ ਕਿ ਲਾੜੀ ਨੂੰ ਬਹੁਤ ਜ਼ਿਆਦਾ ਜਾਣੀ ਕਿ ਪਿਆਰ ਦਿੰਦੇ ਆ ਅਤੇ ਹਰ ਹਰੇਕ ਤਰ੍ਹਾਂ ਦੇ ਤੋਹਫੇ ਦਿੰਦੇ ਹਨ ਜਿਵ ਜਿਵੇਂ ਕਿ ਚੂੜੀਆਂ ਤੋਂ ਟੋਕਸ ਹਾਰ ਕਈ ਤਰ੍ਹਾਂ ਦੇ ਹਾਰ ਹੁੰਦੀਆਂ ਹਨ ਝਾਂਜਰਾਂ ਝੂੰਜਰਾਂ ਬਹੁਤ ਜ਼ਿਆਦੇ ਜਾਣੀ ਕਿ ਵਧੀਆ ਤਰੀਕੇ ਨਾਲ ਤੋਹਫੇ ਦਿੰਦੀਆਂ ਹਨ ਅਤੇ ਲੋ ਲਾੜੀ ਨੂੰ ਲੜਕੇ ਲੜਕਿਆਂ ਵਾਲਿਆਂ ਵੱਲੋਂ ਕਾਫੀ ਜਾਨੀ ਕਿ ਆਦਰ ਸਨਮਾਨ ਦਿੱਤਾ ਜਾਂਦਾ ਹੈ ਕਿ ਕਾਫੀ ਸੋਨੇ ਦੀਆਂ ਚੀਜ਼ਾਂ ਪਾਈਆਂ ਜਾਂਦੀਆਂ ਅਤੇ ਹਰੇਕ ਤਰ੍ਹਾਂ ਦੀਆਂ ਚੀਜ਼ਾਂ ਦਿੰਦੇ ਹਨ ਹਰ ਤਰ੍ਹਾਂ ਨਾਲ ਲਾੜੀ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਜਾਂਦਾ ਹੈ ਲਾੜੀ ਨੂੰ ਆਪਣੇ ਮਾਪਿਆਂ ਵੱਲੋਂ ਵੀ ਬਹੁਤ ਜ਼ਿਆਦਾ ਸਤਿਕਾਰ ਦਿੱਤਾ ਜਾਂਦਾ ਹੈ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਗਿਫਟ ਕੀ ਦਿੱਤੇ ਜਾਂਦੇ ਹਨ ਅਤੇ ਬਹੁਤ ਹੀ ਜ਼ਿਆਦਾ ਆਦਰ ਮਾਣ ਕੀਤਾ ਜਾਂਦਾ ਹੈ ਲਾੜੀ ਨੂੰ ਬਹੁਤ ਜ਼ਿਆਦਾ ਸਤਿਕਾਰ ਦਿੱਤਾ ਜਾਂਦਾ ਹੈ ਅਤੇ ਬਹੁਤ ਵਧੀਆ ਉਹਨੂੰ ਸਤਿਕਾਰ ਦਿੱਤਾ ਜਾਂਦਾ ਹੈ ਅਤੇ ਲਾੜੀ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੇ ਹਨ ਅਤੇ ਲਾੜਾ ਲਾੜੀ ਨੂੰ ਜਾਨੀ ਕਿ ਬਹੁਤ ਜ਼ਿਆਦਾ ਗਿਫਟ ਕੀਤੀ ਦਿੱਤੇ ਜਾਂਦੇ ਹਨ ਗਿਫਟ ਵੀ ਬਹੁਤ ਵਧੀਆ ਦਿੱਤੇ ਜਾਂਦੇ ਆ ਮਾਂ ਪੇ ਦੁਆਰਾ ਵੀ ਬਹੁਤ ਵਧੀਆ ਗਿਫਟ ਦਿੱਤੇ ਜਾਂਦੇ ਹਨ ਅਤੇ ਦੋਸਤਾਂ ਦੋਸਤਾਂ ਯਾਰਾਂ ਵੱਲੋਂ ਵੀ ਕਾਫੀ ਵਧੀਆ ਗਿਫਟ ਦਿੱਤੇ ਜਾਂਦੇ ਹਨ ਅਤੇ ਬਹੁਤ ਵਧੀਆ ਪਿਆਰ ਆਦਰ ਮ ਮਿਲਦਾ ਇਹਨਾਂ ਨੂੰ ਲਾੜੀ ਨੂੰ ਬਹੁਤ ਵਧੀਆ ਸੋਨੇ ਦੇ ਝੂੰਮਕੇ ਝਮਕੇ ਸਭ ਕੁਝ ਦਿੱਤੇ ਜਾਂਦੇ ਚੂੜੀਆਂ ਚਾੜੀਆਂ ਪਹਿਨਾਈਆਂ ਜਾਂਦੀਆਂ ਹਨ ਅਤੇ ਬਹੁਤ ਕੁਝ ਦਿੱਤਾ ਜਾਂਦਾ ਹੈ ਲਾੜੀ ਨੂੰ